ਹਰ ਭਾਸ਼ਾ ਦਾ ਵਿਕਾਸ ਹੁੰਦਾ ਹੈ ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਹਰ ਇੱਕ ਚੀਜ਼ ਦੇ ਵਿਕਸਿਤ ਹੁੰਦੀ ਹੈ ਅਤੇ ਉਸ ਤਰ੍ਹਾਂ ਹੀ ਪੰਜਾਬੀ ਭਾਸ਼ਾ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਵੀ ਆਪਣੇ ਸਮੇਂ ਦੇ ਨਾਲ ਨਾਲ ਇਹਦੇ ਵਿੱਚ ਵੀ ਬਦਲਾਅ ਆ ਰਿਹਾ ਹੈ ਇਹ ਬਦਲਾਅ ਇਸ ਤਰ੍ਹਾਂ ਹੈ ਕਿ ਪੰਜਾਬੀ ਦੇ ਕੁਛ ਵਰਡਸ ਜਿਹੜੇ ਨੇ ਜਾਂ ਦੂਜੀਆਂ ਭਾਸ਼ਾਵਾਂ ਦੇ ਕੁਝ ਵਰਡਸ ਜਿਹੜੇ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਮਿਕਸ ਹੋ ਗਏ ਹਨ ਮਿਲ ਗਏ ਹਨ ਜਿਵੇਂ ਕੋਲਜ ਸ਼ਬਦ ਹੈ ਕੋਲਜ ਸ਼ਬਦ ਯੂਨੀਫੋਮ ਸ਼ਬਦ ਯੂਨੀਫੋਮ ਜਿਹੜੀ ਆਮ ਅਸੀਂ ਉਸ ਤਰ੍ਹਾਂ ਤਾਂ ਇਹਨੂੰ ਵਰਦੀ ਕਿਹਾ ਜਾਂਦਾ ਹੈ ਪਰ ਇੰਨੀ ਕੁ ਜ਼ਿਆਦਾ ਬੱਚਿਆਂ ਦੇ ਵਿੱਚ ਕੋਲਜ ਦੇ ਆਮ ਬੋਲ ਚਾਲ ਦੇ ਵਿੱਚ ਵਿ ਮਿਕਸ ਹੋ ਗਈ ਹੈ ਕਿ ਹੁਣ ਇਸਦਾ ਜਿਹੜਾ ਵਰਦੀ ਦਾ ਕੋਈ ਕੋਈ ਯੂਜ ਕਰਦਾ ਹੈ ਸਾਰੇ ਹੀ ਇਸ ਨੂੰ ਯੂਨੀਫੋਮ ਦੇ ਨਾਲ ਹੀ ਇਸਨੂੰ ਜਾਣਦੇ ਹਨ ਇਸੇ ਤਰ੍ਹਾਂ ਕਾਲਜ ਸ਼ਬਦ ਹੈ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਪਰ ਇਸਨੂੰ ਪੰਜਾਬੀ ਦੇ ਵਿੱਚ ਇੰਨਾ ਕੁ ਜ਼ਿਆਦਾ ਵਰਤਿਆ ਜਾਂਦਾ ਹੈ ਕਿ ਉਸ ਜਿਹੜਾ ਕੋਲਜ ਦਾ ਜਿਹੜਾ ਅ ਮਤਲਬ ਅਸਲੀ ਸੀ ਕਿ ਵਿਦਿਅਕ ਸੰਸਥਾ ਇਕ ਸੰਸਥਾ ਪਰ ਉਹ ਅੱਜ ਜਿਹੜਾ ਹੈ ਸਮ ਸਾਡੇ ਭਾਸ਼ਾ ਦੇ ਵਿੱਚੋਂ ਨਿਕਲ ਰਿਹਾ ਹੈ ਔਰ ਇਸ ਤਰ੍ਹਾਂ ਹੀ ਜਦੋਂ ਬਦਲਾਅ ਆਉਂਦਾ ਹੈ ਭਾਸ਼ਾਵਾਂ ਦੇ ਵਿੱਚ ਤਾਂ ਉਹਦੇ ਵਿੱਚ ਸਾਡੇ ਕਲਚਰ 'ਤੇ ਸੱਭਿਆਚਾਰ 'ਤੇ ਵੀ ਪ੍ਰਭਾਵ ਪੈਂਦਾ ਹੈ ਕਿ ਅਸੀਂ ਦੂਜੇ ਅ ਮਿਕਸ ਹੋਣ ਕਰਕੇ ਰਲ ਮਿਲ ਕੇ ਰਹਿਣ ਕਰਕੇ ਦੂਜਿਆਂ ਦੇ ਸੱਭਿਆਚਾਰ ਜਿਹੜੇ ਹਨ ਉਹ ਸਾਡੇ 'ਤੇ ਜ਼ਿਆਦਾ ਪ੍ਰਭਾਵ ਪਾਉਂਦੇ ਹਨ ਕਿ ਇਸ ਤਰ੍ਹਾਂ ਹੀ ਕਿ ਦੂਜੀਆਂ ਭ ਸੱਭਿਆਚਾਰਾਂ ਦੇ ਪ੍ਰਭਾਵ ਨੂੰ ਅਸੀਂ ਦੇਖਦੇ ਹੋਏ ਉਹ ਹੀ ਸਾਡੇ 'ਤੇ ਜਿਹੜਾ ਸਾ ਸਾਡੇ 'ਤੇ ਵੀ ਪ੍ਰਭਾਵ ਪੈਂਦਾ ਹੈ